ਹਾਂ ਭੰਗੜਾ ਐਰੋਬਿਕਸ ਜਿਸ ਤਰ੍ਹਾਂ ਹੁਣ ਆਪਣੇ ਭੰਗੜਾ ਇ ਇੱਕ ਇੱਦਾਂ ਦੀ ਕਲਾ ਹੈਗੀ ਹੈ ਜੋ ਕਿਸੇ ਨੂੰ ਸਿਖਾਉਣੀ ਨਹੀਂ ਪੈਂਦੀ ਹੈਗੀ ਉਹ ਆਪਣੇ ਆਪ ਹੀ ਆਪਣੇ ਅੰਦਰੂਨੀ ਆਪਣੇ ਅੰਦਰੋਂ ਹੀ ਇੱਕ ਕਲਾ ਹੈ ਉਹ ਉੱਭਰ ਕੇ ਬਾਹਰ ਆਉਂਦੀ ਇਹ ਕੋਈ ਵੀ ਪਾ ਸਕਦਾ ਬੱਚਾ ਵੀ ਪਾ ਸਕਦਾ ਵੱਡਾ ਵੀ ਜਵਾਨ ਵੀ ਸਭ ਵਿਆਹਾਂ ਸ਼ਾਦੀਆਂ 'ਤੇ ਕਿਤੇ ਵਿਆਹ 'ਤੇ ਚਲ ਜਾਓ ਪਾਰਟੀ 'ਤੇ ਚਲ ਜਾਓ ਬੰਦਾ ਜਦ ਤੀਕਰ ਭੰਗੜਾ ਨਹੀਂ ਪਾਇਆ ਉਦੋਂ ਤੱਕ ਕਿਸੇ ਨੂੰ ਤਸੱਲੀ ਹੋਈ ਨਹੀਂ ਹੁੰਦੀ ਹੈਗੀ ਭੰਗੜਾ ਪਾਉਣ ਨਾਲ ਸਰੀਰ ਆਪਣਾ ਬਹੁਤ ਵਧੀਆ ਫਿਟ ਰਹਿੰਦਾ ਜਿਹਨਾਂ ਦੇ ਜਿਹੜੇ ਦੇ ਹੱਡ ਗੋਡੇ ਵਗੈਰਾ ਲੱਤਾਂ ਵਗੈਰਾ ਵੀ ਦਰਦ ਕਰਦੀਆਂ ਹੈ ਉਹ ਵੀ ਭੰਗੜਾ ਪਾਉਣ ਨਾਲ ਵਧੀਆ ਹੋ ਜਾਂਦੇ ਆ ਉਹਨਾਂ ਦੇ ਦਰਦਾਂ ਦੂਰਦਾਂ ਵੀ ਦੂਰ ਹੋ ਜਾਂਦੀਆਂ ਭੰਗੜਾ ਇੱਕ ਐਦਾਂ ਦੀ ਉਹ ਉਹ ਹੈਗੀ ਹੈ ਭੰਗੜਾ ਇੱਦਾਂ ਦਾ ਚੀਜ਼ ਹੈ ਕਿ ਆਪਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਪਾ ਸਕਦੇ ਹੈ ਭੰਗੜੇ ਦੇ ਪਾਉਣ ਵਾਸਤੇ ਕਿਸੇ ਦੀ ਸਿੱਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਭੰਗੜਾ ਪਾਉਣਾ ਆਪਣੀ ਸਿਹਤ ਲਈ ਵੀ ਠੀਕ ਹੈ ਅਤੇ ਸਾਡੇ ਮਨੋਰੰਜਨ ਨੂੰ ਵੀ ਦਰਸਾਉਂਦਾ ਹੈ ਅਤੇ ਸਾਨੂੰ ਅੰਦਰੂਨੀ ਸਾਡੀ ਆਤਮਾ ਵੀ ਭੰਗੜਾ ਪਾ ਕੇ ਖੁਸ਼ ਹੋ ਜਾਂਦੀ ਹੈ ਅਸੀਂ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਜਗ੍ਹਾ ਚਲ ਜਾਓ ਕਿਤੇ ਗਾਣਾ ਲੱਗਿਆ ਹੋਵੇ ਭੰਗੜਾ ਪਾਉਣ ਨੂੰ ਆਪਣੇ ਆਪ ਹੀ ਦਿਲ ਕਰ ਜਾਂਦਾ ਹੈ ਇਸ ਲਈ ਭੰਗੜਾ ਪਾਉਣ ਵਾਲੇ ਹਮੇਸ਼ਾ ਤੰਦਰੁਸਤ ਫਿਟ ਰਹਿੰਦੇ ਹੈ ਅਤੇ ਤੇ ਹਰ ਵੇਲੇ ਖੁਸ਼ ਰਹਿੰਦੇ ਆ ਖਿੜੇ ਖਿੜੇ ਰਹਿੰਦੇ ਆ ਜਦੋਂ ਭੰਗੜਾ ਪਾਉਂਦੇ ਉਦੋਂ ਕੁਦਰਤੀ ਆਪਣੇ ਖੁਸ਼ੀ ਬਾਹਰ ਆ ਜਾਂਦੀ ਹੈ ਧੰਨਵਾਦ